ਮੈਂ ਡਾਂਸ ਤੋਂ ਬਹੁਤ ਹੀ ਜ਼ਿਆਦਾ ਘਬਰਾਉਂਦੀ ਸੀ ਮੈਨੂੰ ਡਾਂਸ ਕਰਨਾ ਵਧੀਆ ਲੱਗਦਾ ਸੀ ਪਰ ਮੈਨੂੰ ਡਰ ਸੀ ਕਿ ਮੇਰੇ ਤੋਂ ਨਹੀਂ ਹੋਣਾ ਇੱਕ ਵਾਰ ਸਾਡੇ ਕਾਲਜ ਵਿੱਚ ਫੰਕਸ਼ਨ ਸੀ ਸਾਰਿਆਂ ਨੇ ਗਰੁੱਪ ਡਾਂਸ ਕਰਨਾ ਸੀ ਅਤੇ ਕੁੜੀਆਂ ਘੱਟ ਗਈਆਂ ਸਨ ਇਸ ਲਈ ਮੇਰੀਆ ਸਹੇਲੀਆਂ ਨੇ ਮੇਰਾ ਲਿਸਟ ਵਿੱਚ ਨਾਮ ਦਰਜ ਕਰਵਾ ਦਿੱਤਾ ਸੀ ਮੈਨੂੰ ਪਹਿਲਾਂ ਬਹੁਤ ਹੀ ਜ਼ਿਆਦਾ ਡਰ ਲੱਗਿਆ ਟੀਚਰਾਂ ਨੇ ਕੁਛ ਦਿਨ ਪਹਿਲਾਂ ਡਾਂਸ ਪ੍ਰੈਕਟਿਸ ਸ਼ੁਰੂ ਕਰਵਾ ਦਿੱਤੀ ਸੀ ਅਤੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਿਆ ਕਰੇ ਨਾ ਮੇਰੇ ਤੋਂ ਕੁੜੀਆਂ ਸਾਹਮਣੇ ਡਾਂਸ ਨਾ ਟੀਚਰ ਸਾਹਮਣੇ ਡਾਂਸ ਹੋਇਆ ਕਰੇ ਫਿਰ ਜਿਸ ਦਿਨ ਡਾਂਸ ਫਾਈਨਲ ਡਾਂਸ ਕਰਨਾ ਸੀ ਉਹ ਦਿਨ ਵੀ ਆ ਗਿਆ ਅਤੇ ਅਤੇ ਮੈਂ ਡਾਂਸ ਕੀਤਾ ਸਾਡੇ ਸਾਰੇ ਗਰੁੱਪ ਨੂੰ ਸਮਾਨਿਤ ਕੀਤਾ ਗਿਆ ਸਾਨੂੰ ਪ੍ਰਿੰਸੀਪਲ ਮੈਮ ਨੇ ਸਾਡੇ ਨਾਲ ਫੋਟੋਜ ਕਰਵਾਈਆ ਅਤੇ ਸਾਨੂੰ ਬਹੁਤ ਹੀ ਜ਼ਿਆਦਾ ਸਾਰਾ ਪਿਆਰ ਮਿਲਿਆ ਅਤੇ ਇਹ ਹੀ ਮੇਰੇ ਜ਼ਿੰਦਗੀ ਦਾ ਸਕਾਰਾਮਤ ਪ੍ਰਭਾਵ ਸੀ ਸਭ ਤੋਂ ਜ਼ਿਆਦਾ